ਰਿਸਪੈਕਟਿਡ ਸਰ ਬੇਨਤੀ ਇਹ ਹੈ ਕਿ ਮੈਂ ਨਿਵਾਸੀ ਰਾਧਾ ਸੁਆਮੀ ਕਲੋਨੀ ਗਲੀ ਨੰਬਰ ਪੰਜ ਨੇੜੇ ਬਾਲਾ ਜੀ ਮੰਦਰ ਮੇਰੇ ਵੱਲੋਂ ਬੇਨਤੀ ਹੈ ਕਿ ਮੈਂ ਇਸ ਪਤੇ ਤੋਂ ਮੇਰਾ ਐਡਰੈਸ ਚੇਂਜ ਹੋ ਕੇ ਮੇਰਾ ਜੋ ਨਵਾਂ ਐਡਰੈਸ ਹੈ ਉਹ ਹੈ ਨਿਊ ਸੂਰਜ ਨਗਰੀ ਗਲੀ ਨੰਬਰ ਪੰਜ ਛੇਵਾਂ ਚੌਂਕ ਅਤੇ ਨੀਅਰ ਪਰਵੀਨ ਮੈਡੀਕਲ ਸਟੋਰ ਇਹ ਮੇਰਾ ਅਬੋਹਰ ਇਹ ਮੇਰਾ ਨਵਾਂ ਐਡਰੈਸ ਹੈ ਮੈਨੂੰ ਜੋ ਆਪਣੇ ਪੀਐਮਕੇਵਾਏ ਪੋਰਟਲ ਲਈ ਆਪਦਾ ਐਡਰੈਸ ਅਪਡੇਟ ਕਰਨਾ ਹੈ ਤਾਂ ਜੋ ਕੋਈ ਵੀ ਅਪਡੇਟ ਜਾਂ ਕੋਈ ਵੀ ਇਨਫੋਰਮੇਸ਼ਨ ਹੋਵੇ ਮੈਨੂੰ ਮੇਰੇ ਨਵੇਂ ਪਤੇ ਤੱਕ ਪਹੁੰਚ ਜਾਏ ਮੇਰਾ ਪੁਰਾਣਾ ਪਤਾ ਚੇਂਜ ਕਰਕੇ ਨਵਾਂ ਪਤਾ ਲਿਖ ਦਿੱਤਾ ਜਾਵੇ ਜੋ ਕਿ ਮੇਰੇ ਨਾਮ ਨਾਲ ਅਟੈਚ ਕਰ ਦਿੱਤਾ ਜਾਵੇ ਤਾਂ ਜੋ ਕੱਲ ਨੂੰ ਮੈਨੂੰ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਨਾ ਹੀ ਮੈਨੂੰ ਕੋਈ ਇਸ ਵਜਹਾ ਕਰਕੇ ਹਾਨੀ ਹੋਏ ਥੈਂਕ ਯੂ